ਮੇਰੀ ਖ ਏਰੀਏ ਦੇ ਵਿੱਚ ਹਸਪਤਾਲ ਹਰੇਕ ਹਸਪਤਾਲ ਦੇ ਵਿੱਚ ਇੱਕ ਅਂਬੂਲੈਂਸ ਹੋਣੀ ਜ਼ਰੂਰੀ ਹੈ ਕਲੀਨਿਕਾਂ ਏ ਜਿਹੜੀਆਂ ਖੋਲ੍ਹੀਆਂ ਉਹਨਾਂ ਦੇ ਵਿੱਚ ਟੈਸਟ ਜਿਹੜੀ ਬਹੁਤ ਜ਼ਰੂਰੀ ਹੈ ਟੈਸਟਾਂ ਖਾਤਰ ਲੋਕਾਂ ਨੂੰ ਘੁੰਮਣਾ ਪੈਂਦਾ ਹੈ ਕਮਿਊਨਿਟੀ ਹੈਲਥ ਸੈਂਟਰ ਜਿਵੇਂ ਆਪਣਾ ਗੱਲ ਕਰੀਏ ਤਾਂ ਇੱਥੇ ਸਟਾਫ਼ ਜਿਹੜਾ ਹਗਾ ਉਹ ਉਹ ਹੋਣਾ ਬਹੁਤ ਜ਼ਰੂਰੀ ਹੈ ਫਾਰਮੇਸੀਆਂ ਜਿਹੜੀਆਂ ਦਵਾਈਆਂ ਇਹ ਘੱਟ ਰੇਟ 'ਤੇ ਮਿਲਣੀਆਂ ਚਾਹੀਦੀਆਂ